ਸਾਡੇ ਇਲਾਕੇ ਵਿੱਚ ਸਭ ਤੋਂ ਸਭ ਅਖ਼ਬਾਰ ਉਪਲਬਧ ਹੈ ਡੇਲੀ ਹੱਟ ਅਖ਼ਬਾਰ ਜਗ ਬਾਣੀ ਨਿਊਜ਼ ਇੱਕ ਹਰ ਤਰ੍ਹਾਂ ਦੀ ਅਖ਼ਬਾਰ ਮਿਲਤੀ ਹੈ ਇਸ ਕਰਕੇ ਇਸ ਬਿਧਤਾ ਸਭ ਦਾ ਇਸ ਦਾ ਕਾਲਮ ਔਰ ਮਨਪਸੰਦ ਇਹ ਹੈ ਕਿ ਅਸੀਂ ਤਾਂ ਹਰ ਰੋਜ਼ ਡੇਲੀ ਹੱਟ ਜਾਂ ਜਗ ਬਾਣੀ ਨੂੰ ਲੈਕ ਕਰਦੇ ਹਾਂ ਬਾਕੀ ਸਭ ਖ਼ਬਰਾਂ ਸੁਣਦੇ ਹਾਂ ਬਾਕੀ ਕਿਸੇ ਵੀ ਕਿਸਮ ਦੀ ਖ਼ਬਰ ਹੋਵੇ ਸਭ ਤੋਂ ਪਹਿਲਾਂ ਜਗ ਬਾਣੀ ਵਿੱਚ ਦਿੱਖ ਕਿਹਾ ਬਾਕੀ ਧਨਿਆਵਾਦ ਜੀ ਨਮਸਕਾਰ